ਅਸੀਂ ਆਪਣੇ ਇਤਿਹਾਸ ਵਿੱਚ ਦੇਖੀਏ ਤਾਂ ਪਹਿਲਾਂ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਪੰਜਾਬੀ ਦੇ ਭਾਸ਼ਾ ਦੇ ਨਾਲ ਨਾਲ ਲੋਕ ਅਰਬੀ ਫਾਰਸੀ ਅਤੇ ਹੋਰ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਸਿੱਖਦੇ ਅਤੇ ਉਹਨਾਂ ਨੂੰ ਬੋਲਦੇ ਸਨ ਪਰ ਜਿਵੇਂ ਜਿਵੇਂ ਇਤਿਹਾਸ ਸਾਡਾ ਬੀਤੇ ਗਏ ਨਵਾਂ ਯੁਗ ਆਉਂਦਾ ਗਿਆ ਇਸ ਦੇ ਨਾਲ ਹੋਰ ਕਈ ਭਾਸ਼ਾਵਾਂ ਆਉਂਦੀਆਂ ਰਹੀਆਂ ਸਭ ਤੋਂ ਜਿ ਜ਼ਿਆਦਾ ਹੁਣ ਜਿਹੜੀ ਬੋਲੀ ਜਾਂਦੀ ਹੈ ਉਹ ਹੈ ਇੰਗਲਿਸ਼ ਇੰਗਲਿਸ਼ ਨੇ ਸਾਡੇ ਪੰਜਾਬੀ ਭਾਸ਼ਾ ਦੇ ਉੱਤੇ ਅਤੇ ਇਸ ਸਾਡੇ ਸੱਭਿਆਚਾਰ ਦੇ ਉੱਤੇ ਬਹੁਤ ਹੀ ਗਹਿਰਾ ਜ਼ਿਆਦਾ ਪ੍ਰਭਾਵ ਪਾਇਆ ਹੈ ਇਸ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਇੰਗਲਿਸ਼ ਹੈ ਉਹ ਬਹੁਤ ਸਾਰੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਆਪਣੇ ਕੰਮਾਂ ਕਾਰਾਂ ਲਈ ਅਤੇ ਆਪਣੇ ਹੋਰ ਕਈ ਬਾਹਰ ਜਾਣ ਦੇ ਲਈ ਆਪਣੀ ਪੜ੍ਹਾਈ ਦੇ ਲਈ ਬੋਲੀ ਜਾਂਦੀ ਹੈ ਇਸ ਦੇ ਨਾਲ ਨਾਲ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਇੰਗਲਿਸ਼ ਨੇ ਲੈ ਲਿਆ ਹੈ ਲੋਕਾਂ ਦਾ ਪਹਿਰਾਵਾ ਉਹਨਾਂ ਦਾ ਖਾਣ ਪੀਣ ਉਹ ਵੀ ਇੰਗਲਿਸ਼ ਦੇ ਵਿੱਚ ਹੀ ਹੋ ਗਿਆ ਹੈ ਲੋਕ ਅੱਜ ਕੱਲ੍ਹ ਵੀ ਇੰਗਲਿਸ਼ ਨੂੰ ਜ਼ਿਆਦਾ ਮਹੱਤਵ ਦੇਣ ਲੱਗ ਗਏ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਲੋਕ ਇਸ ਕਰਕੇ ਇਸ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਇਸ ਭਾਸ਼ਾ ਨੂੰ ਬੋਲਣ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਰੁਜ਼ਗਾਰ ਆ ਉਹ ਵੱਧਦਾ ਹੈ ਉਹ ਜਦੋਂ ਕਿ ਉਹ ਆਪਣੀ ਮਾਤ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਜਿਹੜੀ ਮਾਤ ਭਾਸ਼ਾ ਪੰਜਾਬੀ ਹੈ ਉਸ ਨਾਲ ਉਹਨਾਂ ਨੂੰ ਕੋਈ ਕਾਰੋਬਾਰ ਨਹੀਂ ਮਿਲਦਾ ਉੱਦਾਂ ਦੇ ਕਾਰੋਬਾਰ ਵਿੱਚ ਕੋਈ ਵਾਧਾ ਨਹੀਂ ਹੁੰਦਾ ਉਹਨਾਂ ਨੂੰ ਇੱਕ ਚੰਗੀ ਆਮਦਨੀ ਹੁ ਨਹੀਂ ਹੋ ਸਕਦੀ ਇਸ ਕਰਕੇ ਉਹ ਇੰਗਲਿਸ਼ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਇਸ ਨਾਲ ਜਿਹੜੀ ਹੋਰ ਭਾਸ਼ਾਵਾਂ ਦੇ ਨਾਲ ਨਾਲ ਇੰਗਲਿਸ਼ ਨੇ ਸਾਡੇ ਪੰਜਾਬੀ ਭਾਸ਼ਾ ਅਤੇ ਸਾ ਸੱਭਿਆਚਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ